ਮੈਡੀਕਲ ਅਤੇ ਨਾਨ ਮੈਡੀਕਲ ਸਟਰੀਮ ਦੇ ਵਿੱਚ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਪੜ੍ਹਨਾ ਪੈਂਦਾ ਹੈ ਪੜ੍ਹਨ ਤੋਂ ਬਾਅਦ ਫਿਰ ਕਿਤੇ ਜਾ ਕੇ ਨੌਕਰੀਆਂ ਲੱਗਦੀਆਂ ਹਨ ਅਤੇ ਤਨਖਾਹ ਦਾ ਵੀ ਬਹੁਤ ਅੰਤਰ ਹੁੰਦਾ ਹੈ ਜੇਕਰ ਕੋਈ ਡਾਕਟਰ ਬਣ ਜਾਂਦਾ ਹੈ ਤਾਂ ਆਪਣੀ ਪ੍ਰਾਈਵੇਟ ਪ੍ਰੈਕਟਿਸ ਵੀ ਕਰ ਸਕਦਾ ਹੈ ਅਤੇ ਉਹ ਸਰਕਾਰੀ ਨੌਕਰੀ ਵੀ ਕਰ ਸਕਦਾ ਹੈ ਇਸੇ ਤਰ੍ਹਾਂ ਨੋਨ ਮੈਡੀਕਲ ਰੱਖ ਕੇ ਕੋਈ ਵਿਅਕਤੀ ਸਰਕਾਰੀ ਅਤੇ ਪ੍ਰਾਈਵੇਟ ਕੋਈ ਵੀ ਕੰਮ ਕਰ ਸਕਦਾ ਹੈ ਪਰ ਤਨਖਾਹਾਂ ਵਿੱਚ ਇੱਕ ਵੱਡਾ ਪਾੜਾ ਪਾਇਆ ਜਾਂਦਾ ਹੈ ਇੱਕ ਵਧੀਆ ਡਾਕਟਰ ਦੀ ਤਨਖਾਹ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਮੈਡੀਕਲ ਅਤੇ ਨਾਨ ਮੈਡੀਕਲ ਪੜ੍ਹਨ ਸਮੇਂ ਸਕਾਲਰਸ਼ਿਪ ਵੀ ਦੇਣਾ ਜ਼ਰੂਰੀ ਚਾਹੀਦਾ ਹੈ ਤਾਂ ਕਿ ਕਮਜ਼ੋਰ ਵਿੱਤੀ ਸਹਾ ਕਮਜ਼ੋਰ ਵਰਗ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕੇ ਅਤੇ ਕਮਜ਼ੋਰ ਵਰਗ ਨੂੰ ਬਿਲੋਂਗ ਕਰਦੇ ਬੱਚਿਆਂ ਵਿੱਚ ਮੈਡੀਕਲ ਅਤੇ ਨੋਨ ਮੈਡੀਕਲ ਸਟਰੀਮ ਦੇ ਘਟਦੇ ਰੁਝਾਨ ਨੂੰ ਅਸੀਂ ਠੱਲ ਪਾ ਸਕੀਏ ਅਤੇ ਇਹ ਸਕੋਲਰਸ਼ਿਪ ਦੋਨਾਂ ਹੀ ਵਿਸ਼ਿਆਂ ਦੇ ਵਿੱਚ ਦੇਣੀ ਬਹੁਤ ਜ਼ਰੂਰੀ ਹੈ ਜੇਕਰ ਇਸ ਸਕਾਲਰਸ਼ਿਪ ਨੂੰ ਸਿਰਫ਼ ਮੈਡੀਕਲ ਵਿੱਚ ਵੱਧ ਦਿੱਤਾ ਜਾਂਦਾ ਹੈ ਨਾਨ ਮੈਡੀਕਲ ਵਿੱਚ ਘੱਟ ਦਿੱਤਾ ਜਾਂਦਾ ਹੈ ਤਾਂ ਅਸੀਂ ਵਧੀਆ ਇੰਜੀਨੀਅਰ ਪੈਦਾ ਨਹੀਂ ਕਰ ਸਕਦੇ ਅਤੇ ਜੇਕਰ ਇਸ ਦਾ ਉਲਟਾ ਇੰਜੀਨੀਅਰਿੰਗ ਵਿੱਚ ਵੱਧ ਅਤੇ ਮੈਡੀਕਲ 'ਚ ਘੱਟ ਤਾਂ ਅਸੀਂ ਵਧੀਆ ਡਾਕਟਰ ਪੈਦਾ ਕਰਨ ਵਿੱਚ ਅਸਮਰੱਥ ਹੋ ਜਾਵਾਂਗੇ ਦੋਨਾਂ ਹੀ ਸਟਰੀਮਾਂ ਦੇ ਵਿੱਚ ਵਿੱਤੀ ਸਹਾਇਤਾ ਸਕਾਲਰਸ਼ਿਪ ਵਜੋਂ ਦੇਣੀ ਚਾਹੀਦੀ ਹੈ